ਮਨੁੱਖ ਬ੍ਰਹਿਮੰਡ ਦੇ ਜਿਵੇਂ ਕਿ ਮੰਗਲ ਜਾਂਦਾ ਅਤੇ ਪਹੁੰਚ ਚੁੱਕਿਆ ਹੈ ਉੱਥੇ ਜਾ ਕੇ ਉਨ੍ਹਾਂ ਨੇ ਨਿਰੀਖਣ ਕੀਤਾ ਹੈ ਕਿ ਉੱਥੇ ਪਾਣੀ ਦੇ ਬਿਲਕੁਲ ਵੀ ਤੱਤ ਨਹੀਂ ਹਨ ਪਰ ਪਾਣੀ ਦੇ ਤੱਤ ਹੀ ਸਾਡੇ ਸ ਪਾਣੀ ਦੇ ਤੱਤ ਹੀ ਸਾਡੇ ਸਰੀਰ ਲਈ ਜ਼ਰੂਰੀ ਹਨ ਜਿਵੇਂ ਕਿ ਪਾਣੀ ਦਾ ਸੱਤਰ ਪ੍ਰਸੈਂਟ ਭਾਗ ਸਾਡਾ ਪਾਣੀ ਦਾ ਹੀ ਹੈ ਜਿਸ ਨਾਲ ਕਿ ਅਸੀਂ ਜੀਵਿਤ ਰਹਿ ਸਕਦੇ ਹਾਂ ਜਿਸ ਨਾਲ ਕਿ ਅਸੀਂ ਜੀਵਿਤ ਰਹਿ ਸਕਦੇ ਹਾਂ ਅਤੇ ਕੁਛ ਅਤੇ ਖਾਣਾ ਬਣਾਉਣ ਲਈ ਅਤੇ ਕੁਝ ਉਗਾਉਣ ਲਈ ਖੇਤੀ ਆਦਿ ਕਰਨ ਲਈ ਹੀ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਹਰ ਚੀਜ਼ਾਂ ਵਿੱਚ ਪਾਣੀ ਦਾ ਇਸਤੇਮਾਲ ਹੁੰਦਾ ਹੈ ਪਾਣੀ ਬਿਨਾਂ ਸਾਡਾ ਜੀਵਨ ਹੀ ਸੰਭਵ ਨਹੀਂ ਹੈ ਇਸ ਕਰਕੇ ਇਸ ਕਰਕੇ ਧਰਤੀ 'ਤੇ ਹੀ ਸਾਡਾ ਜੀਵਨ ਸੰਭਵ ਹੈ ਅਤੇ ਸੁਰੱਖਿਅਤ ਸਿੱਧ ਹੈ